ਮੈਨੂੰ ਬਚਪਨ ਵਿੱਚ ਹੀ ਦੌੜਨੇ ਦਾ ਬਹੁਤ ਸ਼ੌਂਕ ਹੈ ਮੈਂ ਨਾ ਬਚਪਨ ਵਿੱਚ ਹੀ ਦੌੜ ਲਗਾਉਣੀ ਆਰੰਭ ਕਰ ਦਿੱਤੀ ਸੀ ਅਤੇ ਸਕੂਲ ਟਾਈਮ ਮੈਂ ਵੱਖ ਵੱਖ ਗੇਮਾਂ ਵਿੱਚ ਦ ਜਿਵੇਂ ਕਿ ਸੌ ਮੀਟਰ ਦੋ ਸੌ ਮੀਟਰ ਚਾਰ ਸੌ ਮੀਟਰ ਦੀ ਦੌੜ ਵਿੱਚ ਭਾਗ ਲੈਂਦਾ ਰਿਹਾ ਹਾਂ ਮੈਂ ਪਹਿਲਾਂ ਜਿਲ੍ਹਾ ਪੱਧਰ ਉੱਤੇ ਖੇਡ ਕੇ ਆਇਆ ਸੀ ਬਾਅਦ ਵਿੱਚ ਨੈਸ਼ਨਲ ਲੈਵਲ ਦੇ ਉੱਤੇ ਗੇਮਾਂ ਦੇ ਵਿੱਚ ਵੀ ਮੈਂ ਭਾਗ ਲਿਆ ਉੱਥੋਂ ਵੀ ਮੈਂ ਫਸਟ ਸੌ ਮੀਟਰ ਦੌੜ ਵਿੱਚ ਫਸਟ ਆਇਆ ਸੀ ਮੈਨੂੰ ਦੌੜਨ ਨਾਲ ਬਹੁਤ ਹੀ ਵਧੀਆ ਲੱਗਦਾ ਹੈ ਮੈਂ ਰੋਜ਼ਾਨਾ ਛੇ ਕਿਲੋਮੀਟਰ ਸਵੇਰੇ ਸੁਵਖਤੇ ਉੱਠ ਕੇ ਦੌੜ ਲਗਾ ਕੇ ਆਉਦਾ ਹਾਂ ਦੌੜ ਲਗਾਉਣ ਨਾਲ ਸਾਡਾ ਤੰਦਰੁਸਤ ਸਰੀਰ ਤੰਦਰੁਸਤ ਰਹਿੰਦਾ ਹੈ ਔਰ ਸਾਡੇ ਸਰੀਰ ਵਿੱਚੋਂ ਜੋ ਪਸੀਨਾ ਨਿਕਲਦਾ ਹੈ ਅਤੇ ਇਸ ਨਾਲ ਸਾਡਾ ਸਰੀਰ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਬਚਦਾ ਹੈ ਸਵੇਰ ਟਾਈਮ ਦੀ ਜੋ ਆਕਸੀਜਨ ਤਾਜ਼ੀ ਸਾਨੂੰ ਮਿਲਦੀ ਹੈ ਉਹ ਸਾਡੇ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ ਦੌੜਨ ਨਾਲ ਸਾਡੇ ਸਾਰੇ ਸਰੀਰ ਦੀ ਵਰਜਿਸ਼ ਹੁੰਦੀ ਹੈ ਔਰ ਸਾਡੇ ਸਰੀਰ ਵਿੱਚੋਂ ਗੰਦਾ ਮੰਦਾ ਪਸੀਨਾ ਬਾਹਰ ਨਿਕਲਦਾ ਹੈ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਸਾਨੂੰ ਹਰੇਕ ਵਿਅਕਤੀ ਨੂੰ ਦੌੜ ਲਗਾਉਣੀ ਚਾਹੀਦੀ ਹੈ